ਸ਼ਹੀਦ ਭਗਤ ਸਿੰਘ ਦਾ ਇਤਿਹਾਸ ਆਸ ਪਾਸ ਸਾਡੇ ਖੇਤਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਤੰਤਰਤਾ ਸਮਾਗਮ ਵਿੱਚ ਯੋਗਦਾਨ ਬਹੁਤ ਮਹੱਤਵਪੂਰਨ ਸੀ ਉਹ ਅਠਾਈ ਸਾਲਾ ਦੀ ਉਮਰ ਵਿੱਚ ਸਿੰਘਾ ਅਤੇ ਹੋਰ ਵਿਰੋਧੀਆਂ ਲਈ ਪ੍ਰੇਰਨਾ ਦਾ ਸਾਥ ਸਾਧਨ ਬਣੇ ਜਵਾਨੀ ਅਤੇ ਪਰੇਨਾ ਭਗਤ ਸਿੰਘ ਦਾ ਜਨਮ ਉੱਨੀ ਸੌ ਸੱਤ ਵਿੱਚ ਪੰਜਾਬ ਦੇ ਵਕੀਲਾਂ ਖਾਨਦਾਨ ਵਿੱਚ ਹੋਇਆ ਉਹਨਾਂ ਦੀ ਦੀਆਂ ਸੋਚਾਂ ਅਤੇ ਰਾਸ਼ਟਰਵਾਦ ਸਮਾਜ ਅਤੇ ਆਥਰ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਬ੍ਰਿਟਿਸ਼ ਰਾਜ ਦੇ ਖਿਲਾਫ ਵਿਰੋਧੀ ਚੀਜ਼ਾਂ ਦਾ ਸਾਹਮਣਾ ਕੀਤਾ ਮੈਟੇ ਦੀ ਸਥਾਪਨਾ ਉਹ ਲਾਹੌਰ ਵਿਖੇ ਗਦਰ ਪਾਰਟੀ ਅਤੇ ਫਿਰ ਹਿੰਦੁਸਤਾਨ ਐਸੋਸ਼ੀਏਸ਼ਨ ਨਾਲ ਜੁੜ ਗਏ ਇਹਨਾਂ ਸੰਗਠਨਾਂ ਦੇ ਬ੍ਰਿਟਿਸ਼ ਹਕੂਮਤ ਖਿਲਾਫ ਹਮਲਿਆਂ ਦੀ ਯੋਜਨਾ ਬਣਾਈ ਜਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉੱ ਸੌ ਅਠਾਈ ਵਿੱਚ ਸਿਟੀ ਪੁਲਿਸ ਦੇ ਅਧਿਕਾਰੀ ਜਿਯਾ ਸਿੰਘ ਦੇ ਵਿਰੁੱਧ ਹਮਲਾ ਕੀਤਾ ਇਸ ਦੇ ਬਾਅਦ ਉਨਾਂ ਨੇ ਲਾਹੌਰ ਬੀ ਐੱਲ ਰਾਏ ਮਾਰਨ ਦੀ ਯੋਜਨਾ ਬਣਾਈ ਸੀ ਪਰ ਗਲਤੀ ਨਾਲ ਉਹਨਾਂ ਨੇ ਕੁਝ ਹੋਰ ਲੋਕਾਂ ਨੂੰ ਵੀ ਬਰਾਬਦ ਕੀਤਾ ਸਭਦੇਸੀ ਖੇਤੀ ਉਹ ਆਪਣੇ ਲਖਾੜੀ ਤੇ ਲਿਖਾਈ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮਦਦਗਾਰ ਸਾਬਿਤ ਹੋਏ ਉਹਨਾਂ ਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਦਿੱਤਾ ਆਜ਼ਾਦੀ ਦੇ ਸਮਾਗਮ ਦਾ ਪ੍ਰਤੀਕ ਬਣ ਗਿਆ ਫਾਂਸੀ ਭਗਤ ਸਿੰਘ ਨੂੰ ਉੱਨੀ ਸੌ ਇਕੱਤੀ ਵਿੱਚ ਫਾਸੀ ਦਿੱਤੀ ਗਈ ਪਰ ਉਹਨਾਂ ਦੀ ਸਹਾਦਤ ਨੇ ਭਾਰਤ ਦੇ ਆਜ਼ਾਦੀ ਦਿਮਾਗ ਵਿੱਚ ਨਵਾਂ ਯੋਗ ਦਿੱਤਾ ਉਹ ਇੱਕ ਪ੍ਰਤੀਕ ਬਣ ਗਏ ਜੋ ਕਿ ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਰਾਜ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦਾ ਹੈ ਭਗਤ ਸਿੰਘ ਦੇ ਯੋਗਦਾਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਹੈ ਉਹ ਆਜ਼ਾਦੀ ਦੇ ਲੜਾਈ ਵਿੱਚ ਇੱਕ ਮਹਾਨ ਦੇ ਵਕਤ ਪਾਸ ਹੋਏ ਭਗਤ ਸਿੰਘ ਦੇ ਆਜ਼ਾਦੀ ਸਮਾਗਮ ਵਿੱਚ ਪਾਏ ਯੋਗਦਾਨ ਬਾਰੇ ਗਹਿਰਾਈ ਨਾਲ ਜਾਣਕਾਰੀ ਪਰਦਾਨ ਕਰਦੇ ਹਾਂ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਭਾਗ ਭਗਤ ਸਿੰਘ ਦੀ ਸੋਚ ਅਤੇ ਲਹਿਰਾਂ ਨੇ ਸਮਾਜਿਕ ਨਿਆਂ ਵਿੱਚ ਔਰਤਾਂ ਦੇ ਬਹੁਤ ਪ੍ਰਭਾਵ ਪਾਇਆ ਉਸ ਵੱਧ ਗਈ ਵਿਚਾਰਾ ਦੇ ਨਾਲ ਸਮਰਥਕ ਰਹੇ ਜਿਨਾਂ ਨੇ ਉਹਨਾਂ ਨੂੰ ਧੰਨ ਧੰਨ ਦਾਰਾ ਤੇ ਦਮ ਨਾਇਕਾ ਰਾਜ ਦੇ ਸ਼ਰਾਬ ਲੜਾਈ ਕਰਨ ਲਈ ਪ੍ਰੇਰਿਤ ਕੀਤਾ ਉਹ ਮੰਨਦੇ ਸਨ ਕਿ ਆਜ਼ਾਦੀ ਦੀ ਲੜਾਈ ਇੱਕ ਸਿਰਫ ਬ੍ਰਿਟਿਸ਼ ਸਰਕਾਰ ਦੇ ਖਿਲਾਫ ਨੀ ਸਗੋ ਸਮਾਜਿਕ ਸਮਾਜਿਕ ਖਿਲਾਫ ਵੀ ਲੜਾਈ ਜਰੂਰੀ